ਸਾਡੇ ਖੇਤਰ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਰਾਜ ਦੇ ਆਰਥਿਕ ਵਿਕਾਸ ਅਤੇ ਵਿਕਾ ਵਿਕਾਸ ਦੇ ਵਿਕਾਸ ਵਿੱਚ ਕਿਵੇਂ ਯੋਗਦਾਨ ਪਾਉਂਦਾ ਹੈ ਸਾਡੇ ਖੇਤਰ ਵਿੱਚ ਸ਼ਿਲਪਕਾਰੀ ਅਤੇ ਆਰ ਸ਼ਿਲਪਕਾਰੀ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦਾ ਹੈ ਅਜਾਇਬ ਘਰ ਅਜਾਇਬ ਘਰ ਜਿੱਦਾਂ ਕਿ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲੱਗਦੀਆਂ ਹਨ ਬਹੁਤ ਸਾਰੇ ਪੁਰਾਣੇ ਸਮਿਆਂ ਦੀਆਂ ਚੀਜ਼ਾਂ ਹਨ ਉਹਨਾਂ ਨਾਲ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਪ੍ਰਦਰਸ਼ਨੀ ਕਰੀ ਜਾਂਦੀ ਹੈ ਅਜਾਇਬ ਘਰ ਵਿੱਚ ਰੱਖ ਕੇ ਅਤੇ ਆਰਥਿਕ ਤੌਰ 'ਤੇ ਵਿਕਾਸ ਹੁੰਦਾ ਹੈ ਅਤੇ ਉਹਨਾਂ ਦੀ ਟਿਕਟ ਲੱਗਦੀ ਹੈ ਟਿਕਟ ਨਾਲ ਜੋ ਪੈਸਾ ਇਕੱਠਾ ਹੁੰਦਾ ਹੈ ਉਸ ਨਾਲ ਆਰਥਿਕ ਵਿਕਾਸ ਹੁੰਦਾ ਹੈ ਅਤੇ ਉਸ ਆਰਥਿਕ ਵਿਕਾਸ ਨਾਲ ਸਾਡੇ ਹੋਰ ਬਹੁਤ ਸਾਰੇ ਰਾਜ ਵਿੱਚ ਜੋ ਖੇਤਰ ਹਨ ਉਹਨਾਂ ਦੀ ਬ ਉਹਨਾਂ ਵਿੱਚ ਬਹੁਤ ਸਾਰਾ ਮਦਦ ਹੁੰਦੀ ਹੈ ਅਜਾਇਬ ਘਰ ਵਿੱਚ ਉਹ ਰੱਖੀਆਂ ਪ੍ਰਦਰਸ਼ਨੀਆਂ ਵਿੱਚ ਜੋ ਟਿਕਟ ਲੱਗਦੀ ਹੈ ਉਹਨਾਂ ਟਿਕਟਾਂ ਨਾਲ ਸਾਡੇ ਸ਼ਿਲਪਕਾਰੀ ਅਤੇ ਸ਼ਿਲਪਕਾਰੀ ਖੇਤਰ ਵਿੱਚ ਅਤੇ ਆਰਥਿਕ ਖੇਤਰ ਵਿੱਚ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਵਿਕਾਸ ਅਤੇ ਯੋਗਦਾਨ ਪਾਉਂਦਾ ਹੈ ਅਜਾਇਬ ਘਰ ਸਾਡੇ ਖੇਤਰ ਸਾਡੇ ਰਾਜ ਦੇ ਸਾਡੇ ਖੇਤਰ ਦੇ ਰਾਜ ਵਿੱਚ